ਮੇਰੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਸਾਰੀ ਚੀਜ਼ਾਂ ਹਨ ਜਿਸਦੀ ਮੈਂ ਕਦਰ ਕਰਦਾ ਹਾਂ ਪਰ ਜਿਸ ਚੀਜ਼ ਦੀ ਮੈਂ ਸਭ ਤੋਂ ਜ਼ਿਆਦਾ ਕਦਰ ਕਰਦਾ ਹਾਂ ਉਹ ਹੈ ਮੇਰੇ ਮਾਂ ਅਤੇ ਪਿਉ ਕਿਉਂਕਿ ਉਨ੍ਹਾਂ ਨੇ ਮੈਨੂੰ ਇਹ ਦੁਨੀਆ ਦਿਖਾਈ ਹੈ ਮੈਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਹੈ ਅਤੇ ਉਹਨਾਂ ਨੇ ਮੈਨੂੰ ਸੰਸਕਾਰ ਜੋ ਦਿੱਤੇ ਹਨ ਕਿ ਜ਼ਿੰਦਗੀ ਨੂੰ ਕਿੱਦਾਂ ਜਿਊਣਾ ਚਾਹੀਦਾ ਹੈ ਇਸ ਕਰਕੇ ਮੈਂ ਉਹਨਾਂ ਦੀ ਕਦਰ ਸਭ ਤੋਂ ਵੱਧ ਕਰਦਾ ਹਾਂ ਅਤੇ ਦੂਜੀ ਗੱਲ ਇਹ ਹੈ ਕਿ ਉਨ੍ਹਾਂ ਦੀ ਕਦਰ ਸ ਇਸ ਲਈ ਕਰਨੀ ਚਾਹੀਦੀ ਹੈ ਕਿਉਂਕਿ ਮਾਪੇ ਰੱਬ ਦਾ ਦੂਜਾ ਰੂਪ ਹੁੰਦੇ ਹਨ ਅਤੇ ਉਨ੍ਹਾਂ ਦੇ ਹੀ ਆ ਆਸ਼ੀਰਵਾਦ ਦੇ ਨਾਲ ਅਸੀਂ ਅੱਗੇ ਜ਼ਿੰਦਗੀ ਵਿੱਚ ਵੱਧ ਸਕਦੇ ਹਨ ਅਤੇ ਸਾਡਾ ਇਹ ਕਰਮ ਅਤੇ ਧਰਮ ਵੀ ਬਣਦਾ ਹੈ ਕਿ ਅਸੀਂ ਆਪਣੇ ਮਾਪਿਆਂ ਦੀ ਉਹਨਾਂ ਦੇ ਬਜ਼ੁਰਗ ਸਮੇਂ ਹਾਲਾਤ ਵਿੱਚ ਸੇਵਾ ਕ ਕਰੀਏ ਅਤੇ ਉਨ੍ਹਾਂ ਨੂੰ ਇੱਕ ਚੰਗਾ ਅਤੇ ਲਾਇਕ ਔਲਾਦ ਬਣ ਕੇ ਦਿਖਾਈਏ ਤਾਂ ਕਿ ਉਹ ਵੀ ਆਪਣੀ ਪਰਵਰਿਸ਼ ਉੱਤੇ ਮਾਣ ਕਰ ਸਕਣ